ਭਾਰਤ ਵਿੱਚ ਬਹੁਤ ਸਾਰੇ ਉਦਯੋਗਪਤੀ ਨੇਤਾ ਹੈ ਜਿਨ੍ਹਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਨੇ ਪਰ ਹੁਣ ਜਦੋਂ ਜਦੋਂ ਦੀ ਮਨ ਮਾਨ ਸਾਹਿਬ ਦੀ ਸਰਕਾਰ ਆਈ ਆ ਉਹ ਤੋਂ ਬਾਅਦ ਤਾਂ ਹੋਰ ਬਹੁਤ ਜ਼ਿਆਦਾ ਤਬਦੀਲੀਆਂ ਹੋਈਆਂ ਨੇ ਦੇਸ਼ ਵਿੱਚ ਤਾਂ ਟੈਕਨੋਲੋਜੀ ਤਾਂ ਬਹੁਤ ਜ਼ਿਆਦਾ ਹੈ ਜ਼ਿਆਦਾ ਹੋ ਚੁੱਕੀ ਹੈ ਸਮਾਰਟ ਫੋਨ ਆ ਚੁੱਕੇ ਆ ਜਿਨ੍ਹਾਂ ਤੋਂ ਸਾਰਾ ਕੰਮ ਹੀ ਹੋ ਜਾਂਦਾ ਆ ਅਤੇ ਸ ਸਿੱਖਿਆ ਵਿੱਚ ਵੀ ਉਹਨਾਂ ਨੇ ਬਹੁਤ ਸਾਰੀਆਂ ਤਗ ਤਬਦੀਲੀਆਂ ਕੀਤੀਆਂ ਵਾ ਜਿਵੇਂ ਸਕੂਲ ਸਕੂਲ ਵਿੱਚ ਬਹੁਤ ਸਾਰਾ ਕੰਮ ਕਰਵਾਇਆ ਜਾ ਰਿਹਾ ਆ ਅਤੇ ਟੀਚਰ ਟੀਚਰ ਨਵੇਂ ਨਵੇਂ ਸਿਰੇ ਤੋਂ ਟੀਚਰ ਆ ਆਏ ਨੇ ਅਤੇ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਉਂਦੇ ਨੇ ਅਤੇ ਉਹਨਾਂ ਨੇ ਮਨੋ ਮਨੋਰੰਜਨ ਕਰਦੇ ਨੇ ਉਹਨਾਂ ਦਾ ਅਤੇ ਬਹੁਤ ਵਧੀਆ ਤਰੀਕੇ ਨਾਲ ਮਾਨ ਸਾਹਿਬ ਨੇ ਇਹਨਾਂ ਦਾ ਸ਼ੁਰੂਆਤ ਕੀਤੀ ਆ ਮੁਹੱਲਾ ਕਲੀਨਿਕ ਲਿਆ ਦਿੱਤੇ ਆ ਅਤੇ ਹੋਰ ਹੋਰ ਆਵਾਜਾਈ ਦਾ ਬਹੁਤ ਵਧੀਆ ਸਾਧਨ ਕਰ ਕਰ ਦਿੱਤਾ ਵਾ ਪੁਲ ਬਣਾ ਦਿੱਤੇ ਆ ਉਹ ਬਹੁਤ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮਾਨ ਸਾਹਿਬ ਨੇ ਬਦ ਬਦਲਾ ਦਿੱਤੀਆਂ ਨੇ ਅਤੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਹੈ